ਸਾਡੇ ਰਾਜ ਦੀ ਬਹੁਤ ਅਮੀਰ ਸੱਭਿਆਚਾਰਕ ਵਿਰਾਸਤ ਹੈ ਜੋ ਕਿ ਸਭ ਤੋਂ ਹੈ ਪੰਜਾਬੀ ਭਾਸ਼ਾ ਦਫਤਰ ਦੇ ਵਿੱਚ ਸਕੂਲਾਂ ਦੇ ਵਿੱਚ ਹਰੇਕ ਜਗ੍ਹਾ 'ਤੇ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ ਸਭ ਤੋਂ ਬੜੀ ਗੱਲ ਸਾਡਾ ਧਰਮ ਜੋ ਕਿ ਪੰਜਾਬੀ ਵਿੱਚ ਹੀ ਸਮਝਾਇਆ ਜਾਂਦਾ ਪੜ੍ਹਾਇਆ ਜਾਂਦਾ ਅਸੀਂ ਖੁਦ ਵੀ ਪੜ੍ਹਦੇ ਹਾਂ ਔਰ ਹਰੇਕ ਜਗ੍ਹਾ 'ਤੇ ਪੰਜਾਬੀ ਭਾਸ਼ਾ ਆਪਣੀ ਭੂਮਿਕਾ ਨਿਭਾਉਂਦੀ ਹੈ